ਹਾਂ ਬਿਲਕੁਲ ਮੈਂ ਤੁਹਾਨੂੰ ਪੰਜਾਬੀ ਵਿੱਚ ਵਿਸਥਾਰ ਨਾਲ ਦੱਸਣਾ ਹਾਂ ਕਿ ਮੈਨੂੰ ਸਭ ਤੋਂ ਪਹਿਲਾਂ ਯੋਗਾ ਦੇ ਅਭਿਆਸ ਵੱਲ ਕਿਸ ਚੀਜ਼ ਨੇ ਖਿੱਚਿਆ ਦੇਖੋ ਗੱਲ ਇਹ ਹੈ ਕਿ ਮੈਂ ਹਮੇਸ਼ਾ ਤੋਂ ਹੀ ਆਪਣੇ ਆਪ ਨੂੰ ਸਿਹਤਮੰਦ ਅਤੇ ਤੰਦਰੁਸਤ ਰੱਖਣ ਦੀ ਕੋਸ਼ਿਸ਼ ਕਰਦਾ ਰਿਹਾ ਹਾਂ ਸ਼ੁਰੂ ਵਿੱਚ ਮੈਂ ਸਿਰਫ਼ ਕਸਰਤ ਅਤੇ ਖੇਡਾਂ 'ਤੇ ਹੀ ਧਿਆਨ ਦਿੰਦਾ ਸੀ ਪਰ ਮੈਨੂੰ ਲੱਗਦਾ ਸੀ ਕਿ ਕੁਝ ਤਾਂ ਘੱਟ ਹੈ ਮੇਰਾ ਮਨ ਅਕਸਰ ਬੇਚੈਨ ਰਹਿੰਦਾ ਸੀ ਮੈਂ ਮਹਿਸੂਸ ਕਰਦਾ ਸੀ ਕਿ ਮੈਨੂੰ ਆਪਣੇ ਸਰੀਰ ਅਤੇ ਮਨ ਦੋਵਾਂ ਨੂੰ ਸ਼ਾਂਤ ਕਰਨ ਦੀ ਲੋੜ ਹੈ ਇੱਕ ਦਿਨ ਮੈਂ ਆਪਣੇ ਇਸ ਦੋਸਤ ਨੂੰ ਯੋਗਾ ਕਰਦਿਆਂ ਕਰਦਿਆਂ ਦੇਖਿਆ ਮੈਂ ਉਹਨਾਂ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ ਉਸ ਦੀ ਸ਼ਾਂਤ ਅਤੇ ਅਸਥਿਰ ਅਵਸਥਾ ਨੇ ਮੈਨੂੰ ਬਹੁਤ ਖਿੱਚਿਆ ਮੈਂ ਉਸ ਨੂੰ ਯੋਗਾ ਬਾਰੇ ਪੁੱਛਿਆ ਉਸਨੇ ਮੈਨੂੰ ਦੱਸਿਆ ਕਿ ਇਹ ਸਿਰਫ਼ ਸ਼ਰੀਰਕ ਕਸਰਤ ਹੀ ਨਹੀਂ ਸਗੋਂ ਮਨ ਅਤੇ ਆਤਮਾ ਨੂੰ ਜੋੜਨ ਦਾ ਤਾਂ ਦਾ ਵੀ ਇਹ ਇੱਕ ਤਰੀਕਾ ਹੈ ਉਸਨੇ ਮੈਨੂੰ ਦੱਸਿਆ ਕਿ ਯੋਗਾ ਨਾਲ ਨਾਲ ਮਨ ਸ਼ਾਂਤ ਹੁੰਦਾ ਹੈ ਤਣਾਅ ਘੱਟ ਹੁੰਦਾ ਹੈ ਅਤੇ ਸਰੀਰ ਵਿੱਚ ਲਕਚ ਲਚਕਤਾ ਅਤੇ ਤਾਕਤ ਆਉਂਦੀ ਹੈ ਮੈਨੂੰ ਇਹ ਗੱਲਾਂ ਬਹੁਤ ਚੰਗੀਆਂ ਲੱਗੀਆਂ ਮੈਂ ਸੋਚਿਆ ਕਿ ਕਿ ਮੈਂ ਇਹ ਮੇਰੇ ਲਈ ਵੀ ਲਾਭਦਾਇਕ ਹੋ ਸਕਦਾ ਹੈ ਮੈਂ ਯੋਗਾ ਬਾਰੇ ਹੋ ਹੋਰ ਜਾਣਕਾਰੀ ਇਕੱਠੀ ਕੀਤੀ ਅਤੇ ਮੈਨੂੰ ਪਤਾ ਲੱਗਿਆ ਕਿ ਇਹ ਇੱਕ ਬਹੁਤ ਹੀ ਪੁਰਾਣੀ ਅਤੇ ਪ੍ਰਭਾਵਸ਼ਾਲੀ ਵਿਧੀ ਹੈ ਇਸ ਨੇ ਮੈਨੂੰ ਮੇਰੇ ਅੰਦਰ ਹੋਰ ਉਤਸੁਕਤਾ ਪੈਦਾ ਕੀਤੀ ਫਿਰ ਮੈਂ ਇੱਕ ਯੋਗਾ ਕਲਾਸ ਵਿੱਚ ਸ਼ਾਮਲ ਹੋ ਗਿਆ ਸ਼ੁਰੂ ਵਿੱਚ ਮੈਨੂੰ ਇਸ ਮੁਸ਼ਕਲਾਂ ਬਹੁਤ ਕੁਝ ਮੁਸ਼ਕਲਾਂ ਆਈਆਂ ਪਰ ਮੈਂ ਹੌਲੀ ਹੌਲੀ ਸਿੱਖਣਾ ਚੋਹ ਸ਼ੁਰੂ ਕਰ ਦਿੱਤਾ ਮੈਨੂੰ ਯੋਗਾ ਦੇ ਆਸਣਾ ਅਤੇ ਪ੍ਰਾਣਾਯਾਮ ਨੇ ਆਪਣੇ ਪਰ ਬਹੁਤ ਪ੍ਰਭਾਵਿਤ ਕੀਤਾ ਕੀਤਾ ਮੈਨੂੰ ਮਹਿਸੂਸ ਹੋਇਆ ਕਿ ਮੈਂ ਸਰੀਰ ਅਤੇ ਮਨ ਦੋਵੇਂ ਸ਼ਾਂਤ ਹੋ ਰਹੇ ਹਨ ਮੇਰਾ ਤਣਾਅ ਘੱਟ ਗਿਆ ਹੋ ਗਿਆ ਹੈ ਅਤੇ ਮੈਂ ਆਪਣੇ ਆਪ ਨੂੰ ਜ਼ਿਆਦਾ ਊਰਜਾਵਾਨ ਅਤੇ ਸਕਾਰਾਤਮਕ ਮਹਿਸੂਸ ਕਰਨ ਲੱਗਿਆ ਇਸ ਤੋਂ ਬਾਅਦ ਮੈਂ ਯੋਗਾ ਨੂੰ ਆਪਣੇ ਯੋਜਨਾ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਮੈਂ ਹਰ ਰੋਜ਼ ਯੋਗਾ ਕਰਦੀ ਸੀ ਅਤੇ ਮੈਨੂੰ ਇਸ ਤੋਂ ਬਹੁਤ ਲਾਭ ਮਿਲਦਾ ਸ ਮਿਲਦਾ ਹੈ ਯੋਗਾ ਦੇ ਮੇਰੀ ਜ਼ਿੰਦਗੀ ਨੂੰ ਬਹੁਤ ਬਦਲ ਦਿੱਤਾ ਹੈ ਮੈਂ ਹੁਣ ਜ਼ਿਆਦਾ ਸ਼ਾਂਤ ਤੰਦਰੁਸਤ ਅਤੇ ਖੁਸ਼ ਹਾਂ ਮੈਨੂੰ ਲੱਗਦਾ ਕਿ ਮੈਂ ਯੋਗਾ ਸਿਰਫ਼ ਇੱਕ ਕਸਰਤ ਨਹੀਂ ਸਗੋਂ ਇੱਕ ਜੀਵਨ ਸ਼ੈਲੀ ਅਤੇ ਉਹਨਾਂ ਨੂੰ ਇਸ ਇਸ ਇਹ ਸਾਨੂੰ ਆਪਣੇ ਆਪ ਨੂੰ ਜੁੜਨ ਅਤੇ ਆਪਣੀ ਅੰਦਰੂਨੀ ਸ਼ਾਂਤੀ ਨੂੰ ਲੱਭਣ ਵਿੱਚ ਮਦਦ ਕਰਦਾ ਹੈ ਅਤੇ ਸਾਰ ਇਹ ਸਾਨੂੰ ਸਰੀਰ ਮਾਨਸਿਕ ਅਤੇ ਆਤਮਿਕ ਤੌਰ 'ਤੇ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਹੈ ਇਹ ਇਸ ਲਈ ਮੈਂ ਕਿਹਾ ਜ ਇਸ ਲਈ ਮੈਂ ਕਹਿ ਸਕਦੀ ਹਾਂ ਕਿ ਮੇਰੀ ਸਿਹਤ ਅਤੇ ਮਨ ਸ਼ਾਂਤੀ ਦੀ ਖੋਜ ਨੇ ਮੈਨੂੰ ਸਭ ਤੋਂ ਪਹਿਲਾਂ ਯੋਗਾ ਦਾ ਅਭਿਆਸ ਵੱਲ ਖਿੱਚਿਆ